ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਖਾਸ ਵਿਕਲਪ ਜਿਹੜੇ ਹਨ ਉਹ ਹੈ ਬੱਸਾਂ ਕਾਰਾਂ ਗੱਡੀਆਂ ਟ੍ਰੇਨਾਂ ਜਿਹੜੇ ਕਿ ਰੂਪਨਗਰ ਦੇ ਲੋਕਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਜਿਵੇਂ ਕਿ ਲੋਕਾਂ ਨੂੰ ਨੌਕਰੀਆਂ ਮੁਹੱਈਆ ਹੁੰਦੀਆਂ ਹਨ ਰੇਲਵੇ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕੰਮ ਕਰ ਰਹੇ ਹੈ ਜਾਂ ਬੱਸਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਇਨ੍ਹਾਂ ਦੇ ਜ਼ਰੀਏ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਉਹ ਆਰਾਮ ਨਾਲ ਆ ਜਾ ਸਕਦੇ ਹਨ ਲੋਕਾਂ ਦਾ ਜਿਹੜਾ ਜਿਹੜਾ ਇਨ੍ਹਾਂ ਚੀਜ਼ਾਂ ਦਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਹੈ ਜਿਹਦੇ ਨਾਲ ਲੋਕਾਂ ਲਈ ਬਹੁਤ ਸੌਖਾ ਹੋ ਚੁੱਕਿਆ ਹੈ ਕਿ ਉਹ ਆਪਣੇ ਸਮੇਂ ਨੂੰ ਜਿਹੜਾ ਉਹਦੀ ਸੰਭਾਲ ਕਰ ਸਕਣ ਉਹ ਇਨ੍ਹਾਂ ਚੀਜ਼ਾਂ ਦੇ ਜ਼ਰੀਏ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਚਲੇ ਜਾਂਦੇ ਹਨ